ਮੇਰੀ ਸਭ ਤੋਂ ਚੁਣੌਤੀਪੂਰਨ ਚਿੱਤਰਕਾਰੀ ਉਹ ਸੀ ਜਦੋਂ ਮੈਂ ਪੋਟਰੇਟ ਪੇਂਟਿੰਗ ਬਣਾਉਣ ਦੀ ਕੋਸ਼ਿਸ਼ ਕੀਤੀ ਮੈਂ ਇੱਕ ਅਰਥ ਵਿਸ਼ਲਿਕ ਸ਼ੈਲੀ ਵਿੱਚ ਇੱਕ ਅਸਲੀ ਜੀਵਨ ਪੋਟਰੇਟ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਹਿਲੀ ਵਾਰੀ ਮੈਂ ਚਿਹਰੇ ਦੀ ਮਾਸੂਮਤਾ ਚਮੜੀ ਦੀ ਰਕਮੀ ਅਤੇ ਰੰਗ ਦੀ ਗੁੱਛਲ ਨੂੰ ਧਿਆਨ ਨਾਲ ਦੇਖ ਰਿਹਾ ਸੀ ਪਰ ਸਭ ਤੋਂ ਵੱਡੀ ਸਮੱਸਿਆ ਸੀ ਅੱਖਾਂ ਦੀ ਜੀਵਨ ਤੱਤਾਂ ਅਤੇ ਚਿਹਰੇ ਦੀ ਸਮਰੋਕਤਾ ਜਦੋਂ ਮੈਂ ਪਹਿਲੀ ਵਾਰ ਚਿਹਰਾ ਪੇਂਟ ਕੀਤਾ ਤਾਂ ਉਹ ਬੇਸ਼ਰਮ ਅਤੇ ਸਖ਼ਤ ਦਿਖ ਰਿਹਾ ਸੀ ਇੱਕ ਅਸਲ ਮਨੁੱਖੀ ਅਭੀਵਿਅਕਤ ਦੀ ਥਾਂ ਉਹ ਬਹੁਤ ਹੀ ਸਧਾਰਨ ਲੱਗ ਰਿਹਾ ਸੀ ਮੈਂ ਛੋਟੀਆਂ ਅੱਖਾਂ ਅਤੇ ਹੇਠਾਂ ਦੀਆਂ ਅਲੱਗ ਅਧਿਅਨ ਬਣਾਉਣੀਆਂ ਸ਼ੁਰੂ ਕੀਤੀਆਂ ਪਹਿਲਾਂ ਮੈਂ ਹੱਦ ਤੋਂ ਵੱਧ ਪਰਫੈਕਸ਼ਨ ਦੀ ਕੋਸ਼ਿਸ਼ ਕਰ ਰਿਹਾ ਸੀ ਬਾਅਦ ਵਿੱਚ ਮੈਂ ਜਦੋਂ ਹੌਲੀ ਹੌਲੀ ਰੰਗ ਮਿਲਾਉਣੇ ਅਤੇ ਥੋੜ੍ਹੀ ਬਿਹਤਰ ਤੀ ਅਪਣਾਈ ਤਾਂ ਚਿਹਰੇ ਵਿੱਚ ਹੋਰ ਜਿਉਤਤ ਆਈ ਚਮੜੀ ਦੇ ਅਸਲ ਟੋਨ ਵਿੱਚ ਗੁਲਾਬੀ ਨੀਲਾ ਪੀਲਾ ਸ਼ਾਮਲ ਕਰਕੇ ਉਹ ਹੋਰ ਪ੍ਰਾਕਿਰਤਿਕ ਲੱਗਣ ਲੱਗੇ